ਸਤਿ ਸ਼੍ਰੀ ਅਕਾਲ ਜੀ ਸਾਜ ਵਿੱਚ ਮੈਨੂੰ ਸਭ ਤੋਂ ਜ਼ਿਆਦਾ ਸਾਜ ਪਸੰਦ ਆ ਬਾਂਸਰੀ ਕਿਉਂਕਿ ਮੈਂ ਆਪਣਾ ਆਈਡਲ ਕ੍ਰਿਸ਼ਨ ਜੀ ਨੂੰ ਮੰਨਦੀ ਮੈਨੂੰ ਕ੍ਰਿਸ਼ਨ ਜੀ ਦਾ ਭਜਨ ਬਹੁਤ ਪਸੰਦ ਆ ਅਤੇ ਬਹੁਤ ਪ੍ਰੇਰਿਤ ਕਰਦੇ ਆ ਮੈਨੂੰ ਕ੍ਰਿਸ਼ਨ ਜੀ ਦਾ ਬਹੁਤ ਅਲੱਗ ਸੀ ਅਟੈਚਮੈਂਟ ਆ ਅਲੱਗ ਜਿਹਾ ਲਗਾਉ ਆ ਜਦੋਂ ਮੈਂ ਕ੍ਰਿਸ਼ਨ ਜੀ ਦੇ ਭਜਨ ਸੁਣਦੀ ਉਹਨਾਂ ਦੀ ਬਾਂਸਰੀ ਸੁਣਦੀ ਹਾਂ ਨਾ ਤਾਂ ਮੈਂ ਮਗਨ ਜਿਹਾ ਪਾਉਂਦੀ ਹਾਂ ਖੁਦ ਨੂੰ ਬਹੁਤ ਵਧੀਆ ਲੱਗਦਾ ਆ ਕ੍ਰਿਸ਼ਨ ਜੀ ਦਾ ਭਜਨ ਬਿਨਾ ਬਾਂਸਰੀ ਤੋਂ ਮੈਨੂੰ ਲੱਗਦਾ ਕਿ ਪੋਸੀਬਲ ਨਹੀਂ ਆ ਕ੍ਰਿਸ਼ਨ ਜੀ ਦਾ ਭਜਨ ਹੋਵੇ ਅਤੇ ਬਾਂਸਰੀ ਨਾ ਵੱਜੇ ਇੱਦਾਂ ਨਹੀਂ ਹੋਣਾ ਚਾਹੀਦਾ ਬਾਂਸੁਰੀ ਦੀ ਵੀ ਅਲੱਗ ਜਿਹੀ ਪਛਾਣ ਆ ਜਿੱਦਾਂ ਹੁਣ ਇੱਕ ਭਜਨ ਹੈਗਾ ਜਬ ਸੇ ਨੈਣ ਮਿਲੇ ਗਿਰਧਰ ਸੇ ਅਕਲ ਗਈ ਬੋਰਾਇ ਉਹ ਬਿਨਾ ਬਾਂਸਰੀ ਦੇ ਬਿਲਕੁਲ ਨਹੀਂ ਗਾਇਆ ਜਾਂਦਾ ਉਹਦੇ ਵਿੱਚ ਜਿਹੜੀ ਬਾਂਸਰੀ ਦੀ ਟਿਊਨਿੰਗ ਆ ਨਾ ਉਹ ਐਨੀ ਕਮਾਲ ਆ ਐਨੀ ਵਧੀਆ ਨਾ ਉਹਨੂੰ ਸੁਣ ਕੇ ਮਜ਼ਾ ਆ ਜਾਂਦਾ ਆ ਅਤੇ ਮੈਨੂੰ ਲੱਗਦਾ ਭਜਨ ਤਾਂ ਜ਼ਿਆਦਾ ਤਾਂ ਮੈਨੂੰ ਉਹ ਬਾਂਸਰੀ ਦੀ ਟਿਊਨਿੰਗ ਹੀ ਪਸੰਦ ਆ ਅਤੇ ਮੈਂ ਉਹਨੂੰ ਹਮੇਸ਼ਾ ਸੁਣਦੀ ਹਾਂ ਕ੍ਰਿਸ਼ਨ ਜੀ ਦੀ ਜਦੋਂ ਭਜਨ ਸੁਣਦੀ ਹਾਂ ਅਲੱਗ ਜਿਹੀ ਪਾਉਂਦੀ ਹਾਂ ਖੁਦ ਨੂੰ ਬੜਾ ਵਧੀਆ ਲੱਗਦਾ ਆ ਮੈਂ ਗਾਉਂਦੀ ਵੀ ਹਾਂ ਅਤੇ ਨਾਲ ਫਿਰ ਬਾਂਸਰੀ ਦੀ ਵੀ ਧੁਨ ਹੁੰਦੀ ਆ ਮਜ਼ਾ ਆ ਜਾਂਦਾ ਹੁਣ ਮੈਂ ਤੁਹਾਨੂੰ ਬਾਂਸਰੀ ਦੀ ਧੁਨ ਸੁਣਾ ਤਾਂ ਨਹੀਂ ਸਕਦੀ ਸ਼ਾ ਮੇਰੀ ਵਿਸ਼ ਸੀ ਮੈਂ ਸੁਣਾਉਂਦੀ ਅਤੇ ਫਿਰ ਤੁਹਾਨੂੰ ਵਧੀਆ ਲੱਗਦਾ ਪਰ ਕਾਫੀ ਅੱਛਾ ਲੱਗਦਾ ਸ਼੍ਰੀ ਕ੍ਰਿਸ਼ਨ ਜੀ ਦੇ ਭਜਨ ਸੁਣ ਕੇ ਅਤੇ ਸ਼੍ਰੀ ਕ੍ਰਿਸ਼ਨ ਜੀ ਮਤਲਬ ਕਿ ਸਭ ਕੁਛ ਸ਼੍ਰੀ ਕ੍ਰਿਸ਼ਨ ਜੀ ਤੋਂ ਬਿਨਾ ਦੁਨੀਆ ਅਧੂਰੀ ਆ ਸੋਚਿਆ ਨਹੀਂ ਜਾ ਸਕਦਾ ਸ਼੍ਰੀ ਕ੍ਰਿਸ਼ਨ ਜੀ ਤੋਂ ਬਿਨਾ ਕੁਛ ਵੀ ਸ਼੍ਰੀ ਕ੍ਰਿਸ਼ਨ ਜੀ ਬਹੁਤ ਜ਼ਿਆਦਾ ਮਤਲਬ ਲਗਾਉ ਦੇ ਰੱਖਦੀ ਹਾਂ ਮੈਂ ਸ਼੍ਰੀ ਕ੍ਰਿਸ਼ਨ ਜੀ ਨਾਲ